ਖੇਤੀਬਾੜੀ ਤੋਂ ਇਲਾਵਾ ਕਿਸਾਨ ਹੋਰ ਵੀ ਕਾਰੋਬਾਰ ਕਰ ਸਕਦੇ ਹਨ ਜਿਵੇਂ ਕਿ ਪਸ਼ੂ ਪਾਲਣ ਦਾ ਧੰ ਪਸ਼ੂ ਪਾਲਣ ਦਾ ਧੰਦਾ ਵ ਉਹਦਾ ਨਾ ਕਿ ਕਿਸਾਨ ਇਸ ਤੋਂ ਵੀ ਕਾਫੀ ਮੁਨਾਫਾ ਉਠਾ ਸਕਦਾ ਹੈ ਕਿਉਂਕਿ ਅਸੀਂ ਪਸ਼ੂ ਪਾਲ ਕੇ ਉਹਨਾਂ ਦੀ ਮਤਲਬ ਪਸ਼ੂ ਪਾਲ ਕੇ ਉਹਨਾਂ ਦੀ ਚੰਗੀ ਸੇਵਾ ਕਰਕੇ ਅਤੇ ਜੋ ਕਿ ਅਸੀਂ ਦੁੱਧ ਹੈ ਉਹ ਚੰਗੇ ਮੁੱਲ ਵੇਚ ਕੇ ਅਤੇ ਅਸੀਂ ਕਾਫੀ ਮੁਨਾਫਾ ਇਸ ਤੋਂ ਇਲਾਵਾ ਹੋਰ ਵੀ ਅਸੀਂ ਮੱਛੀ ਪਾਲਣ ਹੋਰ ਵੀ ਕਾਫੀ ਸਾਰੇ ਕੰਮ ਹੈ ਜੋ ਕਿ ਕਿਸਾਨ ਉਹ ਕਿਸਾਨ ਜੋ ਕਰ ਸਕਦਾ ਹੈ ਇਸ ਤੋਂ ਇਲਾਵਾ ਕਾਰੋਬਾਰ ਚਲਾ ਸਕਦਾ ਹੈ ਕਿਉਂਕਿ ਕਿਸਾਨ ਇਸ ਤੋਂ ਇਲਾਵਾ ਖਾਦਾਂ ਵਗੈਰਾ ਖਰੀਦ ਕੇ ਉਹਨਾਂ ਨੂੰ ਵੀ ਮਹਿੰਗੇ ਭਾਅ ਵੇਚ ਦਿੰਦੇ ਹਨ ਕਿਉਂਕਿ ਕਿਸਾਨ ਜੋ ਹੈ ਜੋ ਮਜ਼ਦੂਰ ਜਾਂ ਕਿਸਾਨ ਹੈ ਜੋ ਅਲੱਗ ਅਲੱਗ ਥਾਵਾਂ ਤੋਂ ਸਮਾਨ ਲੈ ਕੇ ਹੋਲਸੇਲ ਰੇਟ 'ਤੇ ਲੈ ਕੇ ਮਹਿੰਗੇ ਰੇਟ ਵੇਚ ਦਿੰਦੇ ਹਨ ਕਿਸਾਨ ਕੋਈ ਵੀ ਧੰਦਾ ਹੈ ਜੋ ਕਿਸਾਨਾਂ ਲਈ ਮਾੜਾ ਨਹੀਂ ਹੁੰਦਾ ਜੋ ਬੰਦਾ ਮਿਹਨਤ ਕਰਦਾ ਹੈ ਉਹ ਇੱਕ ਨਾ ਇੱਕ ਦਿਨ ਕਾਮਯਾਬ ਹੋ ਜਾਂਦਾ ਹੈ ਅਤੇ ਚੰਗਾ ਪੈਸਾ ਕਮਾਉਂਦਾ ਹੈ ਮੈਂ ਮੈਂ ਆਪਣੇ ਘਰ ਡੈਰੀ ਫਾਰਮ ਖੋਲ੍ਹਿਆ ਹੈ ਜੋ ਕਿ ਮੈਂ ਪੰਜ ਛੇ ਪਸ਼ੂ ਰੱਖੇ ਆ ਮੈਨੂੰ ਪਤਾ ਵੀ ਮੇਰਾ ਬਜਟ ਇੰਨਾ ਕੁ ਹੈ ਅਤੇ ਉਹਨਾਂ ਤੋਂ ਮੈਨੂੰ ਮੈਂ ਉਹਨਾਂ ਦੀ ਚੰਗੀ ਸੇਵਾ ਕਰਦਾ ਅਤੇ ਚੰਗਾ ਮੁਨਾਫਾ ਕਮਾ ਸਕਦਾ ਹਾਂ ਅਤੇ ਮੈਂ ਇਹੀ ਰਾਏ ਦੇਣਾ ਚਾਹੁੰਦਾ ਸਾਰਿਆਂ ਨੂੰ ਕਿ ਤੁਸੀਂ ਆਪਣਾ ਡੈਰੀ ਫਾਰਮ ਦਾ ਧੰਦਾ ਸ਼ੁਰੂ ਕਰੋ ਅਤੇ ਤੁਹਾਡੀ ਉਹ ਬਹੁਤ ਜ਼ਿਆਦਾ ਮਤਲਬ ਇਨਕਮ ਹੋਊਗੀ ਅਤੇ ਵਧੀਆ ਤੁਸੀਂ ਚਾਰ ਪੈਸੇ ਕਮਾਉਣ ਲੱਗ ਜਾਓਗੇ ਤੁਸੀਂ ਘਾਟਾ ਨਹੀਂ ਖਾਂਦੇ ਪਸ਼ੂ ਪਾਲਣ ਦਾ ਧੰਦਾ ਬਹੁਤ ਪਰ ਮਿਹਨਤ ਜ਼ਰੂਰ ਹੈ ਵੀ ਮਿਹਨਤ ਲੱਗਦੀ ਹੈ ਪਰ ਪਰ ਤੁਸੀਂ ਮਿਹਨਤ ਕਰੋਗੇ ਤਾਂ ਹੀ ਇੱਕ ਦਿਨ ਸਫਲ ਹੋ ਜਾਉਗੇ ਧੰਨਵਾਦ ਜੀ